ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਔਰਤਾਂ ਦੇ ਸਾਹਮਣੇ ਮੁੱਖ ਚੁਣੌਤੀਆਂ ਇਹ ਹਨ ਕਿ ਜਿਵੇਂ ਕਿ ਕੁਛ ਔਰਤਾਂ ਘੱਟ ਪੜ੍ਹੀਆਂ ਲਿਖੀਆਂ ਹੁੰਦੀਆਂ ਹਨ ਉਹਨਾਂ ਨੂੰ ਵਧੀਆ ਕੰਮ ਕਾਰ ਨਹੀਂ ਮਿਲਦਾ ਪਰ ਜਿਹੜੀਆਂ ਔਰਤਾਂ ਵਧੀਆ ਪੜ੍ਹੀਆਂ ਹੁੰਦੀਆਂ ਹਨ ਜ਼ਿਆਦਾ ਪੜ੍ਹਾਈ ਲਿਖਾਈ ਕੀਤੀ ਹੁੰਦੀ ਹੈ ਉਹਨਾਂ ਨੂੰ ਰੁਜ਼ਗਾਰ ਵਧੀਆ ਮਿਲ ਜਾਂਦਾ ਵਧੀਆ ਡਿਊਟੀ ਮਿਲ ਜਾਂਦੀ ਹੈ ਨੌਕਰੀ ਮਿਲ ਜਾਂਦੀ ਆ ਔਰ ਉਹਨਾਂ ਨਾਲ ਕਿਸੇ ਵੀ ਔਰਤ ਨਾਲ ਰੂਪਨਗਰ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸਭ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ